ਪਾਣੀ ਜੀਵਨ ਲਈ ਸਭ ਤੋਂ ਅਵਸ਼ਕ ਤੱਤਾਂ ਵਿੱਚੋਂ ਇੱਕ ਹੈ ਅਤੇ ਦਿਨ ਦੇ ਵੱਖ ਵੱਖ ਪਲਾਂ ਵਿੱਚ ਸਾਨੂੰ ਇਸ ਦੀ ਲੋੜ ਵੱਖ ਵੱਖ ਤਰੀਕਿਆਂ ਨਾਲ ਮਹਿਸੂਸ ਹੁੰਦੀ ਹੈ ਸਾਡਾ ਸਰੀਰ ਸੱਤਰ ਸੱਠ ਤੋਂ ਲੈ ਕੇ ਸੱਥਰ ਪਰਸੈਂਟ ਪਾਣੀ ਤੋਂ ਬਣਿਆ ਹੁੰਦਾ ਹੈ ਅਤੇ ਇਹ ਸਾਡੀ ਸਿਹਤ ਉਤਸਾਹ ਅਤੇ ਸਮੱਗਰੀ ਪ੍ਰਣਾਲੀ ਮੈਟਾਬੋਲੋਜਿਮ ਰਾਹੀਂ ਬਹੁਤ ਹੀ ਮਹਤਪੂਰਨ ਹੈ ਜੇਕਰ ਅਸੀਂ ਪਾਣੀ ਦੀ ਕਮੀ ਮਹਿਸੂਸ ਕਰਦੇ ਹਾਂ ਤਾਂ ਇਹ ਸਾਡੇ ਮਾਨਸਿਕ ਅਤੇ ਸ਼ਾਰੀਰਿਕ ਸਮਰੱਥਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਸਵੇਰ ਦੇ ਸਮੇਂ ਪਾਣੀ ਦੀ ਲੋੜ ਜਦ ਅਸੀਂ ਰਾਤ ਪਰ ਸੌ ਰਹੇ ਹੁੰਦੇ ਹਾਂ ਤਾਂ ਸਾਡਾ ਸਰੀਰ ਹੌਲੀ ਹੌਲੀ ਡ੍ਰੀਹਾਈਡਰੇਟ ਹੋ ਜਾਂਦਾ ਹੈ ਰਾਤ ਦੀ ਨੀਂਦ ਤੇ ਬਾਅਦ ਸਾਡੇ ਸਰੀਰ ਨੂੰ ਤਾਜਗੀ ਅਤੇ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਲੋੜ ਪਾਣੀ ਪੀਣ ਨਾਲ ਪੂਰੀ ਕੀਤੀ ਜਾ ਸਕਦੀ ਹੈ ਸਵੇਰੇ ਖਾਲੀ ਪੇਟ ਗੁਣਕਾਰੀ ਪਾਣੀ ਜੈਸੇ ਗੁਣ ਗੁਣਾ ਪਾਣੀ ਜਾ ਲੈਮਨ ਵਾਟਰ ਪੀਨ ਨਾਲ ਪਾਚਨ ਤੰਤਰ ਡਾਈਜੇਸ਼ਨ ਵਧੀਆ ਹੁਣ ਰਹਿੰਦਾ ਹੈ ਸਰੀਰ ਦੇ ਵਿਛੈਲੇ ਤੱਤ ਟੋਕਸਿਨ ਨਿਕਲ ਜਾਂਦੇ ਹਨ ਅਤੇ ਹਾਈਡਰੇਸ਼ਨ ਦੇ ਨਾਲ ਦਿਨ ਵੀ ਚੰਗੀ ਦਿਨ ਦੀ ਚੰਗੀ ਦਿਨ ਦੀ ਚੰਗੀ ਸ਼ੁਰੂਆਤ ਹੁੰਦੀ ਹੈ ਜੇ ਜੋ ਲੋਕ ਸਵੇਰੇ ਨੂੰ ਚਾਹ ਜਾਂ ਕਾਫੀ ਨਾਲ ਸ਼ੁਰੂ ਕਰਦੇ ਹਨ ਉਹਨਾਂ ਨੂੰ ਵੀ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਕੈਫੀਨ ਸ਼ਰੀਰ ਵਿੱਚ ਪਾਣੀ ਦੀ ਕਮੀ ਪੈਦਾ ਕਰ ਸਕਦੀ ਹੈ ਦੁਪਹਿਰ ਦੇ ਕੰਮ ਕਰਨ ਦੇ ਦੌਰਾਨ ਪਾਣੀ ਦੀ ਮਹੱਤਤਾ ਦਿਨ ਦੇ ਦਿਨ ਦੇ ਵੱਧ ਵਿੱਚ ਦਿਨ ਦੇ ਮਧ ਵਿੱਚ ਜਦ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਪੜ੍ ਰਹੇ ਹੁੰਦੇ ਹਾਂ ਜਾਂ ਕਿਸੇ ਸ਼ਾਇਰੀ ਕਿਰਿਆ ਵਿੱਚ ਜਾਂ ਕਿਸੇ ਸ਼ਾਇਰੀ ਕਿਰਿਆ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਸਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਬਹੁਤ ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਸਾਨੂੰ ਖਾਣੇ ਦੀ ਲੋੜ ਹੈ ਪਰ ਅਸਲ ਵਿੱਚ ਸਾਡੇ ਸਰੀਰ ਨੂੰ ਪਾਣੀ ਦੀ ਪਾਣੀ ਦੀ ਘਾਟ ਹੁੰਦੀ ਹੈ ਪਾਣੀ ਪੀਣ ਨਾਲ ਊਰਜਾ ਦੀ ਲੈਵਲ ਵਧਦੀ ਹੈ ਮਾਨਸਿਕ ਚੁਸਤਤਾ ਚੁਸਤਤਾ ਮੈਂਟਲ ਬਾਹਰ ਆਉਂਦੀ ਹੈ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਦੀ ਸਮਰਥਾ ਵਧਦੀ ਹੈ ਜੇਕਰ ਜੇਕਰ ਪਾਂਤਿਨ ਵਿੱਚ ਪਾਣੀ ਘੱਟ ਪੀਤਾ ਜਾਵੇ ਤਾਂ ਥਕਾਵਟ ਸਿਰ ਦਰਦ ਅਤੇ ਧਿਆਨ ਦੀ ਘਾਟ ਜਿਵੇਂ ਸਮੱਸਿਆ ਹੋ ਸਕਦੀਆਂ ਹਨ ਗਰਮ ਮੌਸਮ ਤੇ ਜਿਵੇਂ ਸਮੱਸਿਆ ਹੋ ਸਕਦੀਆਂ ਹਨ ਗਰਮ ਮੌਸਮ ਤੇ ਪਾਣੀ ਦੀ ਜਰੂਰਤ ਜਿਵੇਂ ਕਿ ਗਰਮੀਆਂ ਵਿੱਚ ਤਾਪਮਾਨ ਵਧ ਜਾਂਦਾ ਜਿਵੇਂ ਕਿ ਗਰਮੀਆਂ ਵਿੱਚ ਤਾਪਮਾਨ ਵੱਧ ਜਾਂਦਾ ਹੈ ਤਿਵੇਂ ਤਿਵੇਂ ਸਾਡੇ ਸਰੀਰ ਨੂੰ ਹੋਰ ਵੱਧ ਪਾਣੀ ਦੀ ਲੋੜ ਹੁੰਦੀ ਹੈ ਪਸੀਨਾ ਆਉਣਾ ਕਾਰਨ ਸਰੀਰ ਵਿੱਚ ਪਾਣੀ ਪਸੀਨਾ ਆਉਣਾ ਕਾਰਨ ਸਰੀਰ ਵਿੱਚ ਪਾਣੀ ਅਤੇ ਲਵਣ ਦੀ ਘਾਟ ਹੋ ਜਾਂਦੀ ਹੈ ਜਿਸ ਨਾਲ ਡੀਹਾਈਡਰੇਸ਼ਨ ਹੋਣ ਦਾ ਖਤਰਾ ਰਹਿੰਦਾ ਹੈ ਅਸੀਂ ਹਾਲਤ ਵਿੱਚ ਆਮ ਪਾਣੀ ਦੇ ਨਾਲ ਨਾਲ ਨਾਰੀਅਲ ਪਾਣੀ ਫਲਾਂ ਦਾ ਰਸ ਜਾਂ ਗੁਣਕਾਰੀ ਪਾਣੀ ਉਹ ਆਰਸ ਵਰਤਣਾ ਲਾਭਦਾਇਕ ਹੋ ਸਕਦਾ ਹੈ ਜੋ ਵਿਅਕਤੀ ਖੇਡਾਂ ਜਾਂ ਜੋ ਵਿਅਕਤੀ ਖੇਡਾਂ ਜਾਂ ਭਾਰੀ ਮਿਹਨਤ ਵਾਲੇ ਕੰਮ ਕਰਦੇ ਹਨ ਉਹਨਾਂ ਨੂੰ ਹੋਰ ਵੀ ਵੱਧ ਪਾਣੀ ਪੀਣ ਦੀ ਜਰੂਰਤ ਹੁੰਦੀ ਹੈ ਸ਼ਾਮ ਦੇ ਸਮੇਂ ਹੁੰਦੀ ਹੈ ਸ਼ਾਮ ਦੇ ਸਮੇਂ ਤੇ ਰਾਤ ਨੂੰ ਪਾਣੀ ਪੀਣ ਦਾ ਮਹਿਤ ਸ਼ਾਮ ਦੇ ਸਮੇਂ ਜਦ ਅਸੀਂ ਦਿਨ ਸ਼ਾਮ ਦੇ ਸਮੇਂ ਜਦ ਅਸੀਂ ਦਿਨ ਦੀ ਭਰਮ ਕਰਨ ਤੋਂ ਬਾਅਦ ਆਰਾਮ ਕਰਦੇ ਹਾਂ ਤਾਂ ਅਸੀਂ ਬਹੁਤ ਵਾਰ ਪਾਣੀ ਪੀਣਾ ਭੁੱਲ ਜਾਂਦੇ ਹਾਂ ਪਰ ਇਹ ਸਮਾਂ ਵੀ ਪਾਣੀ ਪੀਣ ਲਈ ਜਰੂਰੀ ਹੁੰਦਾ ਹੈ ਤਾਂ ਕਿ ਸਰੀਰ ਦੀ ਊਰਜਾ ਬਾਹਰ ਆ ਸਕੇ